ਜ਼ਿਲ੍ਹੇ ਵਿੱਚ ਵੇਖਿਆ ਜਾਵੇ ਤਾਂ ਅਲੱਗ ਅਲੱਗ ਪ੍ਰਕਾਰ ਦੀਆਂ ਦਿਲਚਸਪ ਸੈਲਾਨੀਆਂ ਲਈ ਜਿਹੜੀਆਂ ਕਿ ਚੀਜ਼ਾਂ ਬਣਾਈਆਂ ਗਈਆਂ ਨੇ ਜਿਵੇਂ ਕਿ ਵੀ ਆਰ ਪੰਜਾਬ ਜਿੱਥੇ ਕਿ ਤੁਸੀਂ ਮੂਵੀ ਆਪਣੀ ਇੰਟਰਟੈਨਮੈਂਟ ਵਾਸਤੇ ਜਾ ਸਕਦੇ ਹੋ ਅਤੇ ਚੱਪੜਚਿੜੀ ਜਿੱਥੇ ਕਿ ਬਹੁਤ ਜ਼ਿਆਦਾ ਅਲੱਗ ਅਲੱਗ ਜਿਹੜਾ ਕਿ ਹੈਗਾ ਆ ਉਹ ਦੇਖਣ ਲਈ ਉਹ ਤੁਸੀਂ ਆਪਣਾ ਦੇਖ ਕੇ ਆ ਸਕਦੇ ਹੋ ਅਤੇ ਗੁਰਦੁਆਰਾ ਸਾਹਿਬ ਹੈਗਾ ਆ ਸਿੰਘ ਸ਼ਹੀਦਾਂ ਸੁਹਾਣਾ ਜੋ ਕਿ ਬਾਬਾ ਹਨੂੰਮਾਨ ਜੀ ਦੀ ਯਾਦ ਵਿੱਚ ਹੈਗਾ ਹੈ ਅਤੇ ਯਾਤਰੀ ਉੱਥੇ ਵੀ ਮੱਥਾ ਟੇਕਣ ਜਾਂਦੇ ਹਨ